ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਹਾਂ ਅਸੀਂ ਵੀ ਠੀਕ ਆ ਹੋਰ ਬੱਚੇ ਠੀਕ ਨੇ ਜੀ ਅੱਛਾ ਅੱਛਾ ਹਾਂ ਵਧੀਆ ਚੱਲਦੀ ਹੈ ਜੀ

ਇਥੇ ਬਹੁਤ ਵਧੀਆ ਸਕੂਲ ਨੇ ਜੀ ਪੰਜਾਬੀ ਵੀ ਨੇ ਸਰਕਾਰੀ ਵੀ ਨੇ ਅਤੇ ਮਤਲਬ ਕਿ ਆਪਣੇ ਦੂਜੇ ਵੀ ਨੇ ਪ੍ਰਾਈਵੇਟ ਵੀ ਨੇ ਬਹੁਤ ਵਧੀਆ ਸਕੂਲ ਨੇ ਜਿਵੇਂ ਸ਼ਿਵਾਲਿਕ ਸਕੂਲ ਹੈਗਾ ਇੱਕ ਇੱਥੇ ਆਪਣੇ ਸ਼ਹਿਰ ਦੇ ਵਿੱਚ ਹੀ ਅਤੇ ਹਾਂ ਇੱਕ ਏਥੇ ਨਹੀਂ ਨਹੀਂ ਨਹੀਂ ਦੀਦੀ ਇਹ ਤਾਂ ਕੋਈ ਗੱਲ ਨਹੀਂ ਬਹੁਤ ਵਧੀਆ ਸਕੂਲ ਨਹੀਂ ਹੈਗੇ ਸਰਕਾਰੀ 'ਚ ਵੀ ਬਹੁਤ ਵਧੀਆ ਸਹੂਲਤਾਂ ਨੇ ਬਹੁਤ ਵਧੀਆ ਸਕੂਲ ਨੇ ਹਾਂਜੀ ਹਾਂ ਅਤੇ ਪ੍ਰਾਈਵੇਟ ਵੀ ਬਹੁਤ ਵਧੀਆ ਸਕੂਲ ਨੇ ਇਧਰ ਇੱਕ ਆਪਣੇ ਮਤਲਬ ਕਿ ਇਧਰ ਬਠਿੰਡਾ ਰੋਡ 'ਤੇ ਹੀ ਹੈਗਾ ਐਮਪੀਰੀਅਲ ਪਬਲਿਕ ਸਕੂਲ ਆ ਉਥੇ ਵੀ ਬਹੁਤ ਵਧੀਆ ਪੜਾਈ ਹੁੰਦੀ ਹੈਗੀ ਸੀ ਬੀ ਐਸ ਈ ਬੋਰਡ ਆ ਹਾਂਜੀ ਹਾਂ ਇੱਕ ਇਧਰ ਸ਼ਿਵਾਲਿਕ ਸਕੂਲ ਹੈਗਾ ਸ਼ਹਿਰ ਦੇ ਵਿੱਚ ਨਾਲ ਇੱਕ ਇਧਰ ਆਪਣੇ ਇੱਕ ਅਕੈਡਮੀ ਵੀ ਹੈਗੀ ਆ ਅਕਾਲ ਅਕੈਡਮੀ ਇੱਕ ਇਥੇ ਡੇਰਾ ਭਾਈ ਮਸਤਾਨ ਸਕੂਲ ਆ ਉਹ ਵੀ ਬਹੁਤ ਮਸ਼ਹੂਰ ਆ ਬਹੁਤ ਵਧੀਆ ਪੜ੍ਹਾਈ ਹੁੰਦੀ ਆ ਉੱਥੇ ਵੀ ਹਾਂ ਬਾਕੀ ਸਰਕਾਰੀ ਸਰਕਾਰੀ ਸਕੂਲ ਹੈਗਾ ਆਪਣੇ ਸ਼ਹਿਰ ਦੇ ਵਿੱਚ ਹੀ ਆ ਕੁੜੀਆਂ ਦਾ ਕੰਨਿਆ ਹਾਈ ਸਕੂਲ ਹੈ ਹਾਂ ਉਥੇ ਬਹੁਤ ਵਧੀਆ ਪੜ੍ਹਾਈ ਹੁੰਦੀ ਆ ਹਾਂ ਹਾਂ ਹਾਂ ਬਹੁਤ ਸਾਰੇ ਸਟੂਡੈਂਟ ਦੀਦੀ ਬਹੁਤ ਵਧੀਆ ਨੇ ਮਤਲਬ ਕਿ ਆਪਣੇ ਬੱਚੇ ਵਧੀਆ ਇਹਨਾਂ ਸਕੂਲਾਂ 'ਚ ਪੜ੍ਹ ਕੇ ਗਏ ਨੇ ਵੀ ਵਧੀਆ ਸਕੂਲ ਨੇ ਸਾਰੇ ਹੁਣ ਤਾਂ ਅੱਜ ਕੱਲ੍ਹ ਸਿੱਖਿਆ ਹੀ ਸਾ ਉਹ ਆ ਮਤਲਬ ਕਿ ਆਪਣਾ ਵਧੀਆ ਹੈਗਾ ਸਾਰੀ ਟੀਚਰ ਬਹੁਤ ਵਧੀਆ ਪੜ੍ਹਾਉਂਦੇ ਨੇ ਹੈਗੇ ਸਾਰੇ ਸਕੂਲਾਂ 'ਚ ਅੱਛਾ ਅੱਛਾ ਕੁੜੀਆਂ ਦਾ ਸਕੂਲ ਆਪਣੇ ਕੰਨਿਆ ਸਕੂਲ ਬਹੁਤ ਵਧੀਆ ਹੈਗਾ ਤੁਸੀਂ ਉੱਥੇ ਲਾ ਸਕਦੇ ਹੋ ਹਾਂ ਜੀ ਬਾਕੀ ਆਪਣੇ ਇਧਰ ਜਿਵੇਂ ਐਮਪੀਰੀਅਲ ਸਕੂਲ 'ਚ ਲਾਉਣੀ ਆ ਜੇ ਮਤਲਬ ਕਿ ਉੱਥੇ ਵੈਨ ਦੀ ਸੁਵਿਧਾ ਹੈਗੀ ਆ ਵੈਨਾਂ ਵੀ ਹਰੇਕ ਸਕੂਲ ਦੇ ਵਿੱਚ ਵੈਨਾਂ ਦਾ ਵੀ ਵਧੀਆ ਪ੍ਰਬੰਧ ਹੈ ਹਾਂਜੀ ਹਾਂ ਹਾਂ ਦੇਖ ਲਓ ਤੁਸੀਂ ਜਿਵੇਂ ਜੇ ਸਰਕਾਰੀ 'ਚ ਲਾਉਣੀ ਹੈ ਉੱਥੇ ਵੀ ਮਤਲਬ ਕਿਹਾ ਆ ਬਈ ਸਰਕਾਰੀ ਤੁਹਾਨੂੰ ਛੱਡ ਕੇ ਵੀ ਆਉਣਾ ਪਿਆ ਕਰਨਾ ਬੱਚੇ ਨੂੰ ਜਾ ਬੱਚਾ ਆਪਦੇ ਵਹੀਕਲ 'ਤੇ ਵੀ ਜਾ ਸਕਦਾ ਹੈਗਾ ਨੇੜੇ ਹੀ ਆ ਆਪਣੇ ਹਾਂ ਖਾਣਾ ਖੁਣਾ ਬਹੁਤ ਹਾਂਜੀ ਹਾਂ ਖਾਣਾ ਖੁਣਾ ਬਹੁਤ ਵਧੀਆ ਦਿੰਦੇ ਨੇ ਸਰਕਾਰੀ 'ਚ ਹਾਂਜੀ ਹਾਂ ਹਾਂ ਬਹੁਤ ਵਧੀਆ ਪ੍ਰਾਈਵੇਟਾ 'ਚ ਵੀ ਜਿਵੇਂ ਹੁਣ ਤਾਂ ਵੀ ਠੰਡਾ ਖਾਣਾ ਨਹੀਂ ਮਤਲਬ ਕਿ ਬੱਚੇ ਆਪਦੇ ਘਰੋਂ ਟਿਫਨ ਲੈ ਕੇ ਜਾਂਦੇ ਨੇ ਗਰਮ ਓਵਨ ਵਗੈਰਾ ਰੱਖੇ ਹੋਏ ਨੇ ਉਹਨਾਂ ਨੇ ਮੈਕਰੋਵੇਵ ਵਗੈਰਾ ਡਰੈਸ ਪ੍ਰਾਈਵੇਟ ਤਾਂ ਦਿੰਦੇ ਆ ਸਰਕਾਰੀ ਵੀ ਦਿੰਦੇ ਨੇ ਹੁਣ ਤਾਂ ਸਰਕਾਰੀ ਵਾਲੇ ਵੀ ਦੇਣ ਲੱਗ ਗਏ ਜੀ ਹਾਂ ਬਾਕੀ ਆਪਦੀ ਮਰਜ਼ੀ ਹੁੰਦੀ ਆ ਬਾਹਰੋਂ ਲੈਣੀ ਆ ਜਾਂ ਉਸ ਹਿਸਾਬ ਦੀ ਉਥੇ ਗੱਲਬਾਤ ਕਰੀ ਜਾਂਦੀ ਆ ਹਾਂ ਦੇਖ ਲਓ ਤੁਸੀਂ ਟਰਾਈ ਮਾਰੇ ਆਇਓ ਜਿਹੜੇ ਜਿਹੜੇ ਸਕੂਲ ਤੁਹਾਨੂੰ ਠੀਕ ਲੱਗਣਗੇ